ਹਾਂਜੀ ਮੈਂ ਜਸਪ੍ਰੀਤ ਬਾਤ ਕਰ ਰਹੀ ਹੂੰ ਹਾਂਜੀ ਮੈਂ ਠੀਕ ਹੈ ਮੈਂ ਐਜ਼ ਏ ਟੀਚਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਤੁਹਾਨੂੰ ਉਦੋਂ ਪੀਅਨ ਦੀਆਂ ਡਿਊਟੀਜ਼ ਦੱਸੀਆਂ ਸੀਗੀਆਂ ਜਿਵੇਂ ਹੁਣ ਆਪਣੇ ਸਕੂਲ ਚ ਜਿੰਨੀਆਂ ਵੀ ਕਲਾਸਿਜ ਐ ਕਲਾਸ ਰੂਮਜ਼ ਆ ਹੈ ਨਾ ਵਾਸ਼ਰੂਮਜ਼ ਹੈਗੇ ਐ ਬਾਹਰ ਗਾਰਡਨ ਏਰੀਆ ਐ ਵਾਟਰ ਟੈਂਕ ਹੈ ਤੁਸੀਂ ਸਾਰਾ ਕੁਛ ਧਿਆਨ ਰੱਖਣਾ ਉਸ ਚੀਜ਼ਾਂ ਦਾ ਬਈ ਰੂ ਜਿਹੜੇ ਕਮਰੇ ਹੈਗੇ ਆ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਆ ਠੀਕ ਆ ਉਹਦੀ ਡਸਟਿੰਗ ਉਹਦੀ ਝਾੜ ਪੂੰਝ ਪੂਰੀ ਉਤਰੀ ਅੱਛੇ ਤਰੀਕੇ ਨਾਲ ਕਰਨੀ ਹੈ ਕੋਈ ਵੀ ਬੈਂਚ 'ਤੇ ਮੈਨੂੰ ਮਿੱਟੀ ਨਹੀਂ ਦਿੱਖਣੀ ਚਾਹੀਦੀ ਠੀਕ ਹੈ ਅਤੇ ਵਾਸ਼ਰੂਮ ਅਤੇ ਸਾਰੇ ਜਿਹੜੇ ਹੈਗੇ ਆ ਵਾਸ਼ਰੂਮ ਦੇ ਵਿੱਚ ਗੇੜਾ ਲਗਾਉਣਾ ਤੁਸੀਂ ਸਾਰੇ ਪਾਸੇ ਠੀਕ ਹੈ ਮਤਲਬ ਕਲੀਨ ਹੈਗੇ ਸਾਰੇ ਸਾਫ ਸੁਥਰੇ ਹੈਗੇ ਆ ਜਾਂ ਨਹੀਂ ਠੀਕ ਹੈ ਪਾਣੀ ਦਾ ਖਾਸ ਧਿਆਨ ਰੱਖਣਾ ਬੱਚਿਆਂ ਨੂੰ ਸਾਫ਼ ਸੁਥਰਾ ਪਾਣੀ ਮਿਲਣਾ ਚਾਹੀਦਾ ਠੀਕ ਹੈ ਉਹਦੀ ਮੈਨੂੰ ਤੁਸੀਂ ਦੱਸਣਾ ਪਾਣੀ ਦਾ ਵੇਖ ਕੇ ਕਿ ਕੋਈ ਕਚਰਾ ਨਹੀਂ ਉਨ੍ਹਾਂ ਵਿ ਵਿੱਚ ਹੋਣਾ ਚਾਹੀਦਾ ਉੱਤੋਂ ਪੂਰਾ ਕਵਰ ਹੋਣਾ ਚਾਹੀਦਾ ਹੈ ਵਾਟਰ ਟੈਂਕ ਜਿਹੜਾ ਪਿਆ ਹੈਗਾ ਉਹਦੇ ਪਿੱਛੇ ਵੀ ਸਫਾਈ ਕਰਨੀ ਹੈ ਆਪਾਂ ਠੀਕ ਹੈ ਠੀਕ ਹੈ ਅਤੇ ਪੂਰਾ ਆਪਣਾ ਗਾਰਡਨ ਏਰੀਆ ਵੀ ਦੇਖ ਲੈਣਾ ਮਾਲੀ ਨੂੰ ਕਹਿਣਾ ਕਿ ਸਾਰੇ ਪੌਦੇ ਪ ਚੈੱਕ ਕਰਦਾ ਰਹੇ ਹੈ ਨਾ ਪਾਣੀ ਦਾ ਲੈਵਲ ਆਪਦਾ ਚੈਕ ਕਰਦਾ ਰਹੇ ਘਾਹ ਦੇ ਵਿੱਚ ਪਾਣੀ ਛੋੜਨਾ ਕੋਈ ਕੀੜਾ ਪਤੰਗਾ ਮੈਨੂੰ ਦਿਖਣਾ ਨਹੀਂ ਚਾਹੀਦਾ ਨਹੀਂ ਤਾਂ ਮੱਛਰ ਬਹੁਤ ਹੈ ਅੱਜ ਕੱਲ੍ਹ ਅਤੇ ਮੱਛਰ ਮੱਛਰ ਨਹੀਂ ਮੈਨੂੰ ਦਿਖਣਾ ਚਾਹੀਦਾ ਠੀਕ ਹੈ ਉਹਨੂੰ ਬੋਲਣਾ ਹੈ ਦਵਾਈ ਵੀ ਛਿੜਕਣੀ ਹੈ ਸਾਰੇ ਪਾਸੇ ਅਤੇ ਤੁਸੀਂ ਸਾਰੇ ਕਮਰਿਆਂ ਦੀ ਸਫਾਈ ਕਰਨੀ ਹੈ ਅਤੇ ਜਿਹੜਾ ਆਪਣਾ ਸਾਈਕਲ ਸਟੈਂਡ ਹੈਗਾ ਜਿੱਥੇ ਟੀਚਰ ਦੀ ਵੀ ਖੜ੍ਹਦੇ ਐਕਟਿਵਾ ਵਗੈਰਾ ਉਹ ਵੀ ਸਾਰਾ ਧਿਆਨ ਨਾਲ ਦੇਖਣਾ ਤੁਸੀਂ ਠੀਕ ਹੈ ਆਪਦੇ ਨਾਲ ਇੱਕ ਦੋ ਜਣੇ ਲਗਾ ਲੈਣਾ ਅਤੇ ਸਾਰਾ ਚੈੱਕ ਕਰਦੇ ਰਹਿਣਾ ਕਿ ਕੋਈ ਉਹਦੇ ਵਿੱਚ ਮਿੱਟੀ ਘੱਟਾ ਨਹੀਂ ਦਿਖਣਾ ਚਾਹੀਦਾ ਮੈਨੂੰ ਅਤੇ ਉੱਪਰ ਆਪਣੀ ਜਿਹੜੀ ਇੱਕ ਸਾਇੰਸ ਲੈਬ ਵੀ ਬਣੀ ਹੋਈ ਹੈ ਨਾ ਹਾਂ ਉਹਦੇ ਵਿੱਚ ਜਿੰਨੇ ਵੀ ਖਾਨੇ ਬਣੇ ਹੋਏ ਆ ਸਾਇੰਸ ਲੈਬ ਦੇ ਵਿੱਚ ਇੱਕ ਦੇ ਵਿੱਚ ਕੈਮੀਕਲਸ ਪਏ ਆ ਇੱਕ ਦੇ ਵਿੱਚ ਕੋਈ ਹੋਰ ਇੰਸਟਰੂਮੈਂਟਸ ਵੀ ਪਏ ਹੈਗੇ ਆ ਠੀਕ ਹੈ ਉਹ ਸਾਰੇ ਤੁਸੀਂ ਬਾਹਰ ਨਿਕਾਲ ਕੇ ਇੱਕ ਇੱਕ ਡੱਬਾ ਅੱਛੇ ਤਰੀਕੇ ਨਾਲ ਸਾਫ਼ ਕਰਨਾ ਉਹਨੂੰ ਅਤੇ ਪੁਰਾ ਖਾਨੇ ਦੇ ਵੀ ਉਹ ਤੁਸੀਂ ਹੌਲੀ ਹੌਲੀ ਇੱਕ ਵਾਰ ਸ਼ੁਰੂ ਕਰੂੰਗੇ ਸਾਇੰਸ ਲੈਬ ਦੇ ਵਿੱਚ ਇੱਕ ਇੱਕ ਖਾਨਾ ਕਰਕੇ ਤੁਸੀਂ ਸਾਫ ਕਰ ਲੈਣਾ ਇਹਨੂੰ ਇੱਕ ਦੋ ਦਿਨਾਂ ਦੇ ਵਿੱਚ ਪੂਰਾ ਕਰ ਲੈਣਾ ਸਾਫ਼ ਸਫਾਈ ਆਪਦੀ ਸਾਇੰਸ ਲੈਬ ਦੀ ਉਹਦੇ ਵਿੱਚ ਪੂਰੇ ਅੱਠ ਬੈਂਚ ਹੋਣੇ ਚਾਹੀਦੇ ਆ ਉਹ ਵੀ ਗਿਣ ਲੈਣਾ ਠੀਕ ਹੈ ਇੱਕ ਚਿਅਰ ਪਈ ਹੋਣੀ ਚਾਹੀਦੀ ਹੈ ਅੱਠ ਬੈਂਚ ਪੂਰੇ ਹੋਣੇ ਚਾਹੀਦੇ ਆ ਅਤੇ ਬਲੈਕ ਬੋਰਡ ਸਾਫ ਹੋਣਾ ਚਾਹੀਦਾ ਅਤੇ ਸਾਰੇ ਹੀ ਉਹਦੇ ਵਿੱਚ ਜਿਹੜੇ ਖਾਨੇ ਜਿੰਨੇ ਵੀ ਬਣੇ ਹੋਏ ਆ ਉਹ ਸਾਰਾ ਸਮਾਨ ਬਾਹਰ ਕੱਢ ਕੇ ਇੱਕ ਇੱਕ ਖਾਨਾ ਕਰਕੇ ਅਤੇ ਉਹ ਵੀ ਪੂੰਝ ਪੂੰਝ ਕੇ ਸਾਫ ਕਰਕੇ ਵਾਪਿਸ ਰੱਖ ਦੇਣਾ ਠੀਕ ਹੈ ਅਤੇ ਹੋਰ ਫ ਕਮਰੇ ਦੇ ਵਿੱਚ ਹੋਰ ਵੀ ਵੇਖ ਲੈਣਾ ਕਿ ਜਿਹੜੀ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸ ਦੇਣਾ ਆਪਾਂ ਮੰਗਵਾ ਲਾਂਗੇ ਅਤੇ ਉੱਥੇ ਹਮੇਸ਼ਾ ਇੱਕ ਚੌਕ ਡੈਸਟਰ ਬਲੈਕ ਬੋਰਡ ਦੇ ਕੋਲ ਪਿਆ ਹੋਣਾ ਚਾਹੀਦਾ ਠੀਕ ਹੈ ਹਾਂ ਇਹ ਬਾਕੀ ਕਲਾਸ ਰੂਮਜ਼ ਵੀ ਠੀਕ ਹੈ ਬਾਕੀ ਸਾਰੇ ਕਲਾਸ ਰੂਮ ਦੇ ਵੀ ਬੈਂਚ ਤਾਂ ਹੋਣੇ ਚਾਹੀਦੇ ਅਤੇ ਉੱਤੇ ਆਪਦੀ ਸਾਇੰਸ ਲੈਬ ਵੀ ਦੇਖ ਲੈਣਾ ਬਾਹਰ ਜਿਹੜੇ ਸਾਇੰਸ ਲੈਬ ਦੇ ਬਾਹਰ ਵੀ ਜਿਹੜਾ ਹੈਗਾ ਨਾ ਏਰੀਆ ਉਹ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਉਹਦੇ 'ਤੇ ਮੈਂ ਪਰਸੋ ਦੇਖਿਆ ਸੀ ਬੜੀ ਮਿੱਟੀ ਪਈ ਸੀ ਬਾਹਰ ਮਿੱਟੀ ਖਿਲਰੀ ਹੋਈ ਸੀਗੀ ਜਿਵੇਂ ਠੀਕ ਹੈ ਉਹਨੂੰ ਤੁਸੀਂ ਕੱਲ੍ਹ ਤੱਕ ਮੈਨੂੰ ਸਾਫ ਕਰਦੇ ਕਿ ਦੇ ਦੇਣਾ ਠੀਕ ਹੈ ਕਿਉਂਕਿ ਬੱਚੇ ਆਉਂਦੇ ਆ ਫਿਰ ਉਹ ਚੀਜ਼ ਗੰਦੀ ਲੱਗਦੀ ਹੈ ਨਾ ਮਿੱਟੀ ਮਿੱਟੀ ਅੱਛੀ ਨਹੀਂ ਲੱਗਦੀ ਹੈਗੀ ਉਹਦੀ ਤੁਸੀਂ ਝਾੜੂ ਪੋਚਾ ਲਗਾ ਕੇ ਸਾਫ਼ ਸਫਾਈ ਕਰ ਲੈਣਾ ਠੀਕ ਹੈ ਅਤੇ ਬਾਕੀ ਮਾਲੀ ਨੂੰ ਵੀ ਬੋਲਣਾ ਕਿ ਜਿਹੜੇ ਹੈਗੇ ਸਾਰੇ ਇੱਕ ਵਾਰ ਨਿਗਾਹ ਮਾਰੇ ਆਵ ਉਹਨੂੰ ਕਹੋ ਆਪਦਾ ਕੰਮ ਪ੍ਰੋਪਰਲੀ ਕਰਿਆ ਕਰੇ ਪਾਣੀ ਵਗੈਰਾ ਛੋੜਿਆ ਕਰੇ ਠੀਕ ਹੈ ਘਾਹ ਵਗੈਰਾ ਚੱਕ ਰਿਹਾ ਕਰੇ ਹਾਂ ਅਤੇ ਬਾਕੀ ਸਾਰਾ ਆਪਣੇ ਸਕੂਲ ਦਾ ਆਲਾ ਦੁਆਲਾ ਤੁਸੀਂ ਧਿਆਨ ਰੱਖਣਾ